ਵੈਸੇ ਤਾਂ ਮੈਂ ਅਠਾਰ੍ਹਾਂ ਸਾਲ ਦੇ ਨੇ ਹੀ ਕੁਕਿੰਗ ਸਟਾਰਟ ਕਰ ਦਿੱਤੀ ਸੀ ਅਤੇ ਹੁਣ ਮੈਂ ਕੁਕਿੰਗ ਵਿੱਚ ਪੀਜਾ ਬਰਗਰ ਨਿਊਡਲ ਦਾਲ ਰੋਟੀ ਪਨੀਰ ਚੌਲ ਸਾਗ ਆਦਿ ਬਣਾ ਲੈਂਦਾ ਹਾਂ ਪਰ ਮੇਰੇ ਘਰਦਿਆਂ ਨੂੰ ਮੇਰੇ ਹੱਥ ਦੇ ਚੌਲ ਬੜੇ ਪਸੰਦ ਹਨ ਅਤੇ ਜਦੋਂ ਵੀ ਐਤਵਾਰ ਨੂੰ ਮੈਨੂੰ ਛੁੱਟੀ ਹੁੰਦੀ ਹੈ ਤਾਂ ਮੈਂ ਦੁਪਹਿਰ ਦੇ ਸਮੇਂ ਚੌਲ ਬਣਾਉਂਦਾ ਹਾਂ ਅਤੇ ਉਹ ਚੌਲ ਬੜੀ ਮੈਨੂੰ ਬੜੀ ਮਾਤਰਾ ਵਿੱਚ ਬਣਾਉਣੇ ਪੈਂਦੇ ਹਨ ਕਿਉਂਕਿ ਮੇਰੇ ਘਰਦਿਆਂ ਨੂੰ ਬਹੁਤ ਪਸੰਦ ਆਉਂਦੇ ਹਨ ਕਈ ਵਾਰ ਤਾਂ ਮੈਨੂੰ ਵੀ ਨਹੀਂ ਮਿਲਦੇ ਹਨ